ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਬੋਲੋ ਹਾਂਜੀ

ਹਾਂਜੀ ਹਾਂਜੀ ਮੈਮ ਜ਼ਰੂਰ ਮੈਮ ਤੁਸੀਂ ਬਹੁਤ ਹੀ ਵਧੀਆ ਸੁਣਿਆ ਉਹਨਾਂ ਬਾਰੇ ਉਹ ਗੁਰਦੁਆਰਾ ਮੈਮ ਉੱਨੀ ਸੌ ਵੀਹ ਵਿਚ ਬਣਿਆ ਸੀ ਬਾਬਾ ਦੀਪ ਸਿੰਘ ਦੀ ਸ਼ਹਾਦਤ ਦੀ ਯਾਦ ਵਿਚ ਉਹਨਾਂ ਨੇ ਆਪਣੇ ਸੀਸ ਨੂੰ ਤਲੀ 'ਤੇ ਰੱਖ ਕੇ ਜੰਗ ਲੜੀ ਸੀ ਅਫ਼ਗਾਨਾ ਲਈ ਹਾਂਜੀ ਹੁਣ ਉੱਥੇ ਬਹੁਤ ਬਹੁਤ ਦੂਰ ਤੋਂ ਸ ਬਹੁਤ ਬਹੁਤ ਦੂਰ ਤੋਂ ਲੋਕ ਆਂਉਂਦੇ ਨੇ ਘੁੰਮਣ ਲਈ ਉੱਥੇ ਮੱਥਾ ਟੇਕਣ ਲਈ ਹਾਂਜੀ ਹਾਂਜੀ ਤੁਸੀਂ ਹੋਰ ਕੁਛ ਸ ਪੁੱਛਣਾ ਹੋਏ ਤਾਂ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਆਓ